ਪਿੰਡ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਕਿਤਾਬਾਂ ਤਾਂ ਮੁਫਤ ਮਿਲਦੀਆਂ ਨੇ ਅਤੇ ਨਾਲ ਹੀ ਭੋਜਨ ਵੀ ਮਿਡ ਡੇ ਮੀਲ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਕੁਝ ਊਣਤਾਈਆਂ ਨੇ ਜਿਵੇਂ ਪੀਣ ਵਾਲਾ ਪਾਣੀ ਆ ਉਹ ਸਾਫ ਨਹੀਂ ਮਿਲਦਾ ਇਸ ਲਈ ਫਿਲਟਰ ਦੀ ਜ਼ਰੂਰਤ ਹੈ ਸਕੂਲਾਂ ਦੇ ਵਿੱਚ ਫਿਲਟਰ ਲੱਗਣੇ ਚਾਹੀਦੇ ਨੇ ਅਤੇ ਬੈਂਚ ਵੀ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਉਹਦੇ ਮੁਕਾਬਲਤਨ ਜਿਹੜੇ ਬੈਂਚ ਨੇ ਉਹ ਘੱਟ ਨੇ ਬੱਚਿਆਂ ਦੇ ਬੈਠਣ ਦੇ ਲਈ ਅਤੇ ਜਿਹੜੇ ਬਾਥਰੂਮ ਨੇ ਉਹ ਵੀ ਮੁੰਡੇ ਕੁੜੀਆਂ ਦੇ ਅਲੱਗ ਅਲੱਗ ਨਹੀਂ ਹੈਗੇ ਜਿਹੜੇ ਕਿ ਅਲੱਗ ਅਲੱਗ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਦਰਖਤਾਂ ਦੀ ਬਹੁਤ ਘੱਟ ਹੈ ਬੂਟੇ ਨਹੀਂ ਲੱਗੇ ਹੋਏ ਅਤੇ ਇਹਦੇ ਲਈ ਮਾਲੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਕੰਮ ਹੈ ਇਹ ਬੱਚਿਆਂ ਤੋਂ ਨਾ ਕਰਵਾਇਆ ਜਾਵੇ ਇਸ ਤਰ੍ਹਾਂ ਇਹਨਾਂ ਸੁਧਾਰਾਂ ਦੀ ਜਿਹੜੀ ਜ਼ਰੂਰਤ ਹੈਗੀ ਆ ਅਤੇ ਬਿਜਲੀ ਦੇ ਵਿੱਚ ਜਦੋਂ ਬਿਜਲੀ ਚਲੀ ਜਾਂਦੀ ਆ ਉਹਦੇ ਲਈ ਜਰਨੇਟਰ ਦਾ ਪ੍ਰਬੰਧ ਹੋਣਾ ਵੀ ਜ਼ਰੂਰੀ ਹੈ ਤਾਂ ਕਿ ਬੱਚੇ ਅਰਾਮ ਨਾਲ ਪੜ੍ਹ ਸਕਣ